ਪਟਿਆਲਾ ਜ਼ਿਲ੍ਹੇ ਦੀ ਆਰਥਿਕਤਾ ਨਾਲ ਸੰਬੰਧ ਰੱਖਣ ਵਾਲੇ ਉਦਯੋਗ ਜਾਂ ਕਾਰੋਬਾਰ ਦੇ ਵਿੱਚ ਇੱਥੋਂ ਦੇ ਵਿੱਦਿਅਕ ਅਦਾਰੇ ਇੱਥੋਂ ਦਾ ਲੱਕੜ ਮੰਡੀ ਟਰੈਕਟਰਾਂ ਦੀ ਕਬਾੜ ਮਾਰਕੀਟ ਆਦਿਕ ਹਨ ਜਿਨ੍ਹਾਂ ਜਿਨ੍ਹਾਂ ਦਾ ਸਮੇਂ ਦੇ ਨਾਲ ਕਾਫ਼ੀ ਵਿਕਾਸ ਹੋਇਆ ਇਹ ਕਾਫ਼ੀ ਦਹਾਕੇ ਪਹਿਲਾਂ ਇੱਥੇ ਲੱਕੜਾਂ ਦਾ ਕਾਰੋਬਾਰ ਸ਼ੁਰੂ ਹੋਇਆ ਜੋ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਲੱਕੜ ਮੰਡੀ ਦੇ ਨਾਮ ਨਾਲ ਮਸ਼ਹੂਰ ਹੈ ਅਤੇ ਇੱਥੋਂ ਦੀ ਟਰੈਕਟਰ ਮਾਰਕੀਟ ਕਬਾੜ ਬਾਜ਼ਾਰ ਦੇ ਨਾਮ ਨਾਲ ਜਾਣੀ ਜਾਂਦੀ ਹੈ ਅਤੇ ਇੱਥੋਂ ਦੇ ਵਿੱਦਿਅਕ ਅਦਾਰੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਲੋਅ ਯੂਨੀਵਰਸਿਟੀ ਜਗਤ ਗੁਰੂ ਨਾਨਕ ਯੂਨੀਵਰਸਿਟੀ ਆਦਿਕ ਇੱਥੋਂ ਦੀਆਂ ਵਿੱਦਿਅਕ ਅਦਾਰੇ ਹਨ ਜੋ ਕਿ ਪੰਜਾਬ ਦੇ ਪੇਂਡੂ ਇਲਾਕੇ ਨਾਲ ਸੰਬੰਧਿਤ ਰੱਖਣ ਵਾਲੇ ਵਿਦਿਆਰਥੀਆਂ ਨੂੰ ਰੁਜ਼ਗਾਰ ਅਤੇ ਵਿੱਦਿਆ ਦੇ ਨਾਂ ਇੱਕ ਬਹੁਤ ਵਧੀਆ ਅਤੇ ਵੱਡਾ ਵਿੱਦਿਅਕ ਅਦਾਰਾ ਹੈ